ਸਾਡੇ ਖੇਤਰ ਵਿੱਚ ਦੋ ਹੀ ਮੁੱਖ ਕੁਦਰਤੀ ਸਰੋਤ ਪਾਏ ਜਾਂਦੇ ਹਨ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦਾ ਕਰਕੇ ਰੇਤ ਇੱਥੋਂ ਦਾ ਮੁੱਖ ਸਰੋਤ ਹੈ ਜੋ ਮਾਈਨਿੰਗ ਕਰਕੇ ਕੱਢਿਆ ਜਾਂਦਾ ਹੈ ਅਤੇ ਕੁਝ ਪਹਾੜੀ ਇਲਾਕਾ ਹੋਣ ਕਰਕੇ ਉੱਥੋਂ ਛੋਟੀ ਬਜਰੀ ਜਿਹੜੀ ਆ ਬਜਰ ਉੱਥੋਂ ਪੱਥਰਾਂ ਨੂੰ ਤੋੜ ਕੇ ਬਜਰੀ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਅਤੇ ਇਸ ਨੂੰ ਵਪਾਰ ਦੇ ਤੌਰ 'ਤੇ ਵੱਖ ਵੱਖ ਖੇਤਰਾਂ ਦੇ ਵਿੱਚ ਭੇਜਿਆ ਜਾਂਦਾ ਹੈ ਅਤੇ ਇਹ ਇੱਕ ਵਪਾਰ ਦਾ ਮੁੱਖ ਸਾਧਨ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦਾ ਕਰਕੇ ਉੱਥੇ ਪਾਵਰ ਪਲਾਂਟ ਲੱਗੇ ਹੋਏ ਹਨ ਜਿਸ ਤੋਂ ਕਿ ਬਿਜਲੀ ਉਤਪੰਨ ਕਰਕੇ ਕੁਝ ਸਾਡੇ ਖੇਤਰ ਵਿੱਚ ਵਰਤੀ ਜਾਂਦੀ ਹੈ ਕੁਝ ਬਿਜਲੀ ਉਹ ਬਾਹਰ ਦੇ ਖੇਤਰਾਂ ਨੂੰ ਭੇਜ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜੋ ਵੀ ਖਨਨ ਹੋ ਰਿਹਾ ਹੈ ਉਹ ਕੁਝ ਕੁਦਰਤੀ ਵੀ ਹੋ ਰਿਹਾ ਹੈ ਕੁਝ ਗੈਰ ਕੁਦਰਤੀ ਵੀ ਹੋ ਰਿਹਾ ਹੈ ਇਸ ਕਰਕੇ ਇਹਦੇ ਬਾਰੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਹਨੂੰ ਇੱਕ ਕਾਨੂੰਨੀ ਤੌਰ ਦੇ ਉੱਤੇ ਇੱਕ ਲੀਗਲ ਤੌਰ ਦੇ ਉੱਤੇ ਜਿਸ ਜਿੰਨੀ ਜ਼ਰੂਰਤ ਹੈ ਉਸ ਹਿਸਾਬ ਦੇ ਨਾਲ ਹੀ ਇਸ ਦੀ ਵਰਤੋਂ ਕੀਤੀ ਜਾਵੇ